ਇਹ ਕਥਨੀ ਬਿਲਕੁਲ ਸਹੀ ਹੈ ਕਿ ਸਮੇਂ ਦੇ ਨਾਲ ਫੋਟੋਗ੍ਰਾਫਰ ਦੀ ਭੂਮਿਕਾ ਬਦਲ ਗਈ ਹੈ ਔਰ ਇਹ ਆਪਾਂ ਇਸ ਲਈ ਕਹਿ ਸਕਦੇ ਹਾਂ ਕਿਉਂਕਿ ਖੇਤੀਬਾੜੀ ਵੱਲੋਂ ਟਿਉਲਿਪ ਦੇ ਫੁੱਲਾਂ ਦੀ ਕਾਸ਼ਤ ਇੱਕ ਸ਼ਲਾਘਾਯੋਗ ਉੱਦਮ ਹੈ ਇਹ ਪਹਿਲੀ ਵਾਰ ਹੈ ਕਿ ਦਰਸ਼ਕਾਂ ਨਾਲ ਦਰਸ਼ਕਾਂ ਨੂੰ ਲੁਧਿਆਣੇ ਵਿੱਚ ਕਸ਼ਮੀਰ ਦੇ ਫੁੱਲਾਂ ਦੇ ਦਰਸ਼ਨ ਹੋ ਰਹੇ ਹਨ ਇਹ ਸੁੰਦਰਤਾ ਜੈ ਵਿਭਿੰਨਤਾ ਅਤੇ ਵਾਤਾਵਰਨ ਸੈਰ ਸਪਾਟੇ ਦੇ ਸੁਮੇਲ ਵਾਲਾ ਇੱਕ ਵਿਸ਼ੇਸ਼ ਫੁੱਲਾਂ ਦਾ ਸ਼ਾਹਕਾਰ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਅਤੇ ਲੈਂਡਸਕੇਪਿੰਗ ਵਿਭਾਗ ਵੱਲੋਂ ਟਿਊਲਿਪ ਬਲਬ ਹੋਲੈਂਡ ਤੋਂ ਦ ਬਰਾਮਦ ਕੀਤੇ ਗਏ ਹਨ ਇਹ ਫੁੱਲਾਂ ਦੇ ਬਲਬ ਉਸੇ ਸਪਲਾਈਅਰ ਰਾਹੀਂ ਪ੍ਰਾਪਤ ਕੀਤੇ ਗਏ ਹਨ ਜਿਸ ਕੋਲੋਂ ਕਸ਼ਮੀਰ ਅਤੇ ਸ਼੍ਰੀਨਗਰ ਵਿਖੇ ਸਭ ਤੋਂ ਵੱਡੇ ਟਿਉਲਿਪ ਗਾਰਡਨ ਲਈ ਬਰਾਮਦ ਕੀਤੇ ਗਏ ਹਨ ਉੱਥੇ ਨਵੀਂ ਤਿਆਰ ਕੀਤੀ ਗਈ ਟਿਊਲਿਪ ਬਗੀਚੀ ਮਨਮੋਹਕ ਫੁੱਲਾਂ ਰਾਹੀ ਖਿੱਚ ਦਾ ਕੇਂਦਰ ਬਣ ਚੁੱਕੀ ਹੈ ਇਹ ਨਾ ਸਿਰਫ ਲੁਧਿਆਣਾ ਦੇ ਨਾਗਰਿਕਾਂ ਨੂੰ ਸਗੋਂ ਆਸ ਪਾਸ ਦੇ ਰਾਜਾਂ ਦੇ ਲੋਕਾਂ ਨੂੰ ਵੀ ਆਕਰਸ਼ਤ ਕਰੇਗੀ ਇਸ ਨਵੀਂ ਵਿਕਸਿਤ ਭਿੰਨ ਭਿੰਨ ਰੰਗਾਂ ਦੇ ਟਿਉਲਿਪ ਬਗੀਚੀ ਵਿੱਚ ਵੱਧਦੀਆਂ ਘਟਦੀਆਂ ਕਿਸਮਾਂ ਦੇ ਟਿਉਲਿਪ ਫੁੱਲਾਂ ਨੂੰ ਲਗਾਇਆ ਗਿਆ ਹੈ ਇਹ ਬਗੀਚੀ ਹਰਿਆਲੇ ਪੱਤਿਆਂ ਦੀ ਛੋਹ ਵਾਲੇ ਫੁੱਲਾਂ ਨਾਲ ਇੱਕ ਵਿਲੱਖਣ ਨਜ਼ਾਰਾ ਪੈਦਾ ਕਰ ਰਹੀ ਹੈ ਅਤੇ ਦੇਖਣ ਵਾਲਿਆਂ ਨੂੰ ਖਿੱਚ ਪਾਉਂਦੀ ਹੈ ਇਹਨਾਂ ਫੁੱਲਾਂ ਦੀ ਸੁੰਦਰਤਾ ਉਹਨਾਂ ਦੇ ਉਜਲੇ ਰੰਗ ਅਤੇ ਨਿਰਮਲ ਖੁਸ਼ਬੂਆਂ ਵਾਲੀ ਇੱਕ ਆਕਰਸ਼ਿਕ ਬਗੀਚੀ ਬਣ ਗਈ ਹੈ ਜੋ ਲੋਕਾਂ ਨੂੰ ਹੋਲੈਂਡ ਅਤੇ ਕਸ਼ਮੀਰ ਦੇ ਪ੍ਰਸਿੱਧ ਟਿਉਲਿਪ ਬਗੀਚਿਆਂ ਦੀ ਯਾਦ ਦਿਵਾਉਂਦੀ ਹੈ ਲੁਧਿਆਣਾ ਵਿੱਚ ਟਿਉਲਿਪ ਬਲਬਾਂ ਦੀ ਕਾਸ਼ਤ ਜੋ ਹੋਲੈਂਡ ਤੋਂ ਬਰਾਬਮਦ ਕੀਤੇ ਗਏ ਹਨ ਅਤੇ ਇਹਨਾਂ ਦੀ ਕਟਾਈ ਪੰਜਾਬ ਵਿੱਚ ਫਲੋਰੀਕਲਚਰ ਨੂੰ ਵਧਾਉਣ ਲਈ ਇੱਕ ਵੱਡਾ ਕਦਮ ਹੈ ਇਹ ਨਵੀਂ ਤਿਆਰ ਕੀਤੀ ਗਈ ਟਿਉਲਿਪ ਬਗੀਚੀ ਜਿਸ ਨੂੰ ਸਪਰਿੰਗ ਗਾਰਡਨ ਵਜੋਂ ਵੀ ਜਾਣਿਆ ਜਾਂਦਾ ਹੈ ਪੰਜਾਬ ਵਿੱਚ ਫਲੋਰੀਕਲਚਰ ਨੂੰ ਵਧਾਉਣ 'ਚ ਲੱਗੇ ਲੋਕਾਂ ਨੂੰ ਆਪਣੀਆਂ ਫਸਲਾਂ ਦੀ ਵੰਨਸੁਵੰਨਤਾ ਕਰਕੇ ਆਰਥਿਕ ਅਤੇ ਵਾਤਾਵਰਨਿਕ ਲਾਭ ਪ੍ਰਾਪਤ ਕਰਨ ਲਈ ਪ੍ਰੇਰਿਤ ਕਰੇਗੀ ਆਸ ਕੀਤੀ ਜਾ ਸਕਦੀ ਹੈ ਕਿ ਇਹ ਟਿਉਲਿਪ ਬਗੀਚੀ ਆਪਣੀ ਖੂਬਸੂਰਤੀ ਕਾਰਨ ਫੁੱਲਾਂ ਦੇ ਸ਼ੌਕੀਨ ਲੋਕਾਂ ਲਈ ਖਿੱਚ ਦਾ ਇੱਕ ਅਹਿਮ ਆਕਰਸ਼ਣ ਬਣ ਜਾਵੇਗੀ ਜਿਸ ਵਿੱਚ ਲੋਕ ਟਿਉਲਿਪ ਦੇ ਫੁੱਲਾਂ ਦੇ ਰੰਗਤ ਦਾ ਆਨੰਦ ਮਾਨਣ ਦੇ ਨਾਲ ਨਾਲ ਇਹ ਵੱਖ ਵੱਖ ਸੱਭਿਆਚਾਰਕ ਅਤੇ ਸਮਾਜਿਕ ਸਰਗਰਮੀਆਂ ਜਿਵੇਂ ਕਿ ਫੁੱਲ ਪ੍ਰਦਰਸ਼ਨੀ ਫੋਟੋਗ੍ਰਾਫੀ ਮੁਕਾਬਲੇ ਅਤੇ ਵਿਦਿਅਕ ਸੈਮੀਨਾਰ ਆਯੋਜਿਤ ਕਰਨ ਨੂੰ ਉਤਸ਼ਾਹਿਤ ਕਰੇਗੀ ਜੋ ਵਿਦਿਆਰਥੀਆਂ ਦੀ ਰੁਚੀ ਨੂੰ ਉਤਸ਼ਾਹਿਤ ਕਰਨ ਦਾ ਵੱਡਾ ਯੋਗਦਾਨ ਪਾਉਣਗੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਮੇਸ਼ਾ ਹੀ ਰਾਜ ਦੇ ਵਿਕਾਸ ਲਈ ਖੇਤੀ ਦੇ ਖੇਤਰ ਦੀ ਅਗਵਾਈ ਕਰਦੀ ਰਹੀ ਹੈ ਅਤੇ ਹੁਣ ਨਵੰਬਰ ਦੋ ਹਜ਼ਾਰ ਚੌਵੀ ਵਿੱਚ ਟਿਉਲਿਪ ਬਲਬਾਂ ਦੀ ਕਾਸ਼ਤ ਵੀ ਬੇਸ਼ਕ ਸ਼ਲਾਘਾਯੋਗ ਕਦਮ ਹੈ ਪੀ ਏ ਯੂ ਦੇ ਨਾਲ ਉਪ ਕੁੱਲ ਪੱਤੀ ਡਾਕਟਰ ਸਤਬੀਰ ਸਿੰਘ ਗੋਸਲ ਨੇ ਇਸ ਉੱਦਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਟਿਉਲਿਪ ਗਾਰਡਨ ਸਿਰਫ ਇੱਕ ਦੇਖਣ ਯੋਗ ਬਗੀਚੀ ਹੀ ਨਹੀਂ ਹੈ ਇਹ ਵੀ ਇਹ ਪੀ ਏ ਯੂ ਦੀ ਫਲੋਰੀਕਲਚਰ ਜੈਵ ਵਿੰਨਤਾ ਸੰਭਾਲ ਅਤੇ ਟਿਕਾਊ ਲੈਂਡਸਕੇਪਿੰਗ ਪ੍ਰਤੀ ਵਚਨਬੱਧਤਾ ਦੀ ਇੱਕ ਜਿਉਂਦੀ ਜਾਗਦੀ ਉਦਾਹਰਨ ਹੈ ਧੰਨਵਾਦ